ਹੈਲੋ ਸ਼ਿਵ ਸ਼ਕਤੀ ਰੈਸਟੋਰੈਂਟ ਦੀ ਰਿਸੈਪਸ਼ਨ ਤੋਂ ਗੱਲ ਕਰਦੇ ਓਂ ਅਸਲ ਵਿੱਚ ਮੈਂ ਤੁਹਾਡੇ ਤੋਂ ਇੱਕ ਮਦਦ ਚਾਹੁੰਦਾ ਹਾਂ ਮਿਤੀ ਚੌਵੀ ਦਸੰਬਰ ਨੂੰ ਮੇਰੇ ਭਰਾ ਦਾ ਜਨਮਦਿਨ ਹੈ ਜਿਸ ਵਿੱਚ ਅਸੀਂ ਫਰੈਂਡਸ ਅਤੇ ਫੈਮਲੀ ਮੈਂਬਰਸ ਹੋਵਾਂਗੇ ਕੁੱਲ ਪੰਦਰ੍ਹਾਂ ਮੈਂਬਰ ਹੋਣਗੇ ਮੈਂ ਤੁਹਾਡੇ ਰੈਸਟੋਰੈਂਟ ਵਿੱਚੋਂ ਉਹ ਪਾਰਟੀ ਦੀ ਅਰੇਂਜਮੈਂਟ ਕਰਨਾ ਚਾਹੁੰਦਾ ਹਾਂ ਅਤੇ ਮੈਨੂੰ ਤੁਹਾਡੇ ਰੈਸਟੋਰੈਂਟ ਵਿੱਚ ਬੈਠਣ ਦੀ ਉਪਲਬਧਤਾ ਦਾ ਕੀ ਪ੍ਰਬੰਧ ਹੈ ਦੱਸਿਆ ਜਾਵੇ ਅਤੇ ਪਾਰਕਿੰਗ ਵਿੱਚ ਕਿੰਨਾਂ ਚਾਰਜਸ ਹੈ ਕਿੰਨਾਂ ਸਮੇਂ ਲਈ ਕਰ ਸਕਦੇ ਹਾਂ ਭੋਜਨ ਵਿੱਚ ਕਿੰਨੀਆਂ ਵਰਾਇਟੀਆਂ ਹਨ ਕਿਹੋ ਜਿਹਾ ਭੋਜਨ ਹੈ ਕਿੰਨੇ ਵਜੇ ਰੈਸਟੋਰੈਂਟ ਦੀ ਕਲੋਜਿੰਗ ਟਾਈਮ ਕਿੰਨਾਂ ਹੈ ਉਹ ਦੱਸਿਆ ਜਾਵੇ ਕਸਟਮਰ ਸਰਵਿਸ ਅਤੇ ਸਟਾਫ ਦਾ ਬਿਹੇਵ ਕਿਵੇਂ ਦਾ ਹੈ ਅਤੇ ਸਟਾਫ ਚੰਗੀ ਤਰ੍ਹਾਂ ਸਾਫ ਸਫਾਈ ਨਾਲ ਕੰਮ ਕਰਦਾ ਹੈ ਕਿ ਨਹੀਂ ਦੱਸਿਆ ਜਾਵੇ ਸਾਫ ਸਫਾਈ ਸੰਬੰਧੀ ਜਾਣਕਾਰੀਆਂ ਦਿੱਤੀਆਂ ਜਾਣ ਹਾਈਜੀਨਿਕ ਲੇਵਲ ਦਾ ਪੂਰਾ ਪ੍ਰਬੰਧ ਹੋਵੇ ਸਿਰ ਉੱਪਰ ਕੈਪਸ ਅਤੇ ਹੱਥਾਂ ਵਿੱਚ ਗਲੱਬਸ ਹੋਣ ਅਤੇ ਅਲੱਗ ਅਲੱਗ ਖਾਣੇ ਦੀਆਂ ਵਰਾਇਟੀਆਂ ਹੋਣ ਬੱਚਿਆਂ ਲਈ ਕੋਈ ਚਟਪਟਾ ਖਾਣਾ ਹੋਵੇ ਅਤੇ ਸੀਨੀਅਰ ਮੈਂਬਰਾਂ ਲਈ ਕੁਝ ਸਿੰਪਲ ਖਾਣਾ ਹੋਵੇ ਅਤੇ ਬਾਕੀ ਤੁਹਾਡਾ ਧੰਨਵਾਦ ਜੇ ਸਾਨੂੰ ਸਾਰਾ ਕੁਛ ਮਿਲ ਜਾਂਦਾ ਹੈ ਤਾਂ ਅਸੀਂ ਜ਼ਰੂਰ ਆਵਾਂਗੇ ਓਕੇ ਬਾਏ